ਸਮੇਂ ਦੇ ਨਾਲ ਨਾਲ ਯੋਗ ਦਾ ਅਭਿਆਸ ਵਿਕਸਿਤ ਹੋ ਹੀ ਜਾਂਦਾ ਜਿਵੇਂ ਵੀ ਜਿਵੇਂ ਕਿ ਆਪਾਂ ਕੋਈ ਵੀ ਕੰਮ ਕਰਦੇ ਹਾਂ ਤਾਂ ਉਹਨੂੰ ਬਾਰ ਬਾਰ ਕਰਨ ਨਾਲ ਬਾਰ ਬਾਰ ਕਰਨ ਇੱਕ ਤਾਂ ਆਪਾਂ ਉਹਦੇ 'ਚ ਬਿਲਕੁਲ ਪਰਫੈਕਟ ਹੋ ਜਾਂਦੇ ਹਾਂ ਬਿਲਕੁਲ ਹੈ ਨਾ ਅਤੇ ਦੂਜੀ ਗੱਲ ਇਹ ਹੈ ਕਿ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿਸੇ ਚੀਜ਼ ਦੀ ਆਪਾਂ ਨੂੰ ਹੌਲੀ ਹੌਲੀ ਉਹ ਚੀਜ਼ ਦੇ ਫਾਇਦੇ ਦਿਖਣੇ ਸ਼ੁਰੂ ਹੁੰਦੇ ਆ ਹੈ ਨਾ ਆਪਾਂ ਨੂੰ ਉਹਨਾਂ ਦਾ ਰਿਜ਼ਲਟ ਦਿਖਦਾ ਅਤੇ ਯੋਗ ਦਾ ਵੀ ਯੋਗਾ ਦਾ ਵੀ ਆ ਯੋਗ ਦਾ ਵੀ ਇਹੀ ਹਿਸਾਬ ਹੁੰਦਾ ਜਿਵੇਂ ਜਿਵੇਂ ਟਾਈਮ ਚੱਲਦਾ ਰਹਿੰਦਾ ਆ ਜਿਵੇਂ ਜਿਵੇਂ ਸਮਾਂ ਜਾਂ ਗੁਜ਼ਰਦਾ ਰਹਿੰਦਾ ਆਪਾਂ ਅਭਿਆਸ ਕਰਦੇ ਰਹਿੰਦੇ ਕਰਦੇ ਰਹਿੰਦੇ ਹਾਂ ਤਾਂ ਆਪਾਂ ਨੂੰ ਉਵੇਂ ਹੀ ਆਪਣੇ ਸਰੀਰ ਦੇ ਵਿੱਚ ਉਵੇਂ ਦੇ ਰਿਜ਼ਲਟ ਦੇਖਣ ਨੂੰ ਮਿਲਦੇ ਆ ਜਿਵੇਂ ਕਿ ਫਲੈਕਸੀਬਿਲਟੀ ਹੈ ਨਾ ਆਪਣਾ ਪਲਜ਼ ਸਥਿਰ ਰਹਿੰਦੀ ਆ ਹਾਰਟਬੀਟ ਸਹੀ ਰਹਿੰਦੀ ਆ ਕੋਈ ਆਪਾਂ ਨੂੰ ਦਿਲ ਦੀ ਬਿਮਾਰੀ ਨਹੀਂ ਲੱਗਦੀ ਹੈਗੀ ਮੋਟਾਪਾ ਨਹੀਂ ਹੁੰਦਾ ਹੈਗਾ ਹਾਈਟ ਵੱਧਦੀ ਹੈ ਜੋੜਾਂ ਦਾ ਦਰਦ ਨਹੀਂ ਰਹਿੰਦਾ ਹੈਗਾ ਹੱਡੀਆਂ ਮਜ਼ਬੂਤ ਹੁੰਦੀਆਂ ਆਪਣਾ ਸਰੀਰ ਮਜ਼ਬੂਤ ਬਣਦਾ ਤਾਂ ਇਹ ਸਭ ਆਪਾਂ ਨੂੰ ਸਮੇਂ ਦੇ ਨਾਲ ਨਾਲ ਜਦੋਂ ਆਪਾਂ ਨੂੰ ਇਹ ਰਿਜ਼ਲਟ ਦੇਖਣ ਨੂੰ ਮਿਲਦੇ ਆ ਤਾਂ ਆਪਣਾ ਹੋਰ ਅਭਿਆਸ ਹੁੰਦਾ ਰਹਿੰਦਾ ਹੁੰਦਾ ਰਹਿੰਦਾ ਹੁੰਦਾ ਰਹਿੰਦਾ ਅਤੇ ਆਪਾਂ ਇਹਨੂੰ ਛੱਡਦੇ ਨਹੀਂ ਹੈਗੇ ਅਤੇ ਜਦੋਂ ਲਗਾਤਾਰ ਕਰਦੇ ਰਹਿੰਦੇ ਹਾਂ ਤਾਂ ਆਪਾਂ ਇਹਦੇ 'ਚ ਪਰਫੈਕਟ ਹੋ ਜਾਂਦੇ ਹਾਂ